ਮੇਰਾ ਨਾਮ ਰਜਨੀ ਹੈ ਅਤੇ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਮੈਂ ਅਠਾਰ੍ਹਾਂ ਜੂਨ ਯਾਨੀ ਕਿ ਅੱਜ ਦੁਪਹਿਰ ਨੂੰ ਡੋਮਿਨੋਜ਼ ਦੇ ਵਿੱਚ ਇੱਕ ਪੀਜ਼ਾ ਔਡਰ ਕੀਤਾ ਸੀਗਾ ਜਿਸ ਦੀ ਮੈਨੂੰ ਅਰਜੈਂਟ ਡਿਲੀਵਰੀ ਚਾਹੀਦੀ ਸੀਗੀ ਪਰੰਤੂ ਤੁਹਾਡੇ ਡਿਲੀਵਰੀ ਦੇ ਵਿੱਚ ਦੇਰੀ ਹੋਣ ਦੇ ਕਾਰਨ ਮੈਨੂੰ ਉਹ ਔਡਰ ਕੈਂਸਲ ਕਰਨਾ ਪਿਆ ਸੀਗਾ ਪ੍ਰੰਤੂ ਮੈਂ ਉਸ ਔਡਰ ਦੀ ਐਡਵਾਂਸ ਦੇ ਵਿੱਚ ਔਨਲਾਈਨ ਪੇਮੈਂਟ ਕਰ ਦਿੱਤੀ ਹੋਈ ਸੀਗੀ ਅਤੇ ਮੈਨੂੰ ਹਜੇ ਤੱਕ ਕੈਂਸਲ ਕਰਨ ਤੋਂ ਬਾਅਦ ਉਸ ਪੇਮੈਂਟ ਦਾ ਕੋਈ ਰਿਫੰਡ ਨਹੀਂ ਆਇਆ ਮੈਂ ਤੁਹਾਡੇ ਕੋਲੋਂ ਮੈਂ ਤੁਹਾਡੇ ਕੋਲੋਂ ਇਸ ਪਾਰਸਲ